ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੇਰਾ ਨਾਮ ਅਰਸ਼ਪ੍ਰੀਤ ਸਿੰਘ ਹੈ ਅਤੇ ਮੈਂ ਚੰਡੀਗੜ੍ਹ ਤੋਂ ਬੋਲਦਾ ਜੀ ਮੈਂ ਇੱਕ ਫੂਡ ਫੂਡ ਬਲੋਗਰ ਹੈ ਜੀ ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀਗਾ ਕਿ ਮਤਲਬ ਪੰਜਾਬ ਦੇ ਮਤਲਬ ਫੇਮਸ ਫੂਡ ਕਿਹੜੇ ਕਿਹੜੇ ਹੈ ਜੀ ਠੰਡ ਦਾ ਟਾਈਮ ਅਜੇ ਤਾਂ ਜੀ ਮਤਲਬ ਕਿਹੜੇ ਕਿਹੜੇ ਮਤਲਬ ਜ਼ਿਆਦਾ ਫੇਮਸ ਉੱਥੇ ਦੇ ਅੱਛਾ ਜੀ ਅਤੇ ਹੋਰ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਭਾਅ ਜੀ ਮੈਂ ਨਾ ਫਰੂਟ ਵਲੋਗਰ ਆ ਤਾਂ ਮਤਲਬ ਮੈਂ ਤੁਹਾਡੇ ਕੋਲ ਆਉਂਗਾ ਤੁਸੀਂ ਮੈਨੂੰ ਘੁੰਮਾ ਕੇ ਮਤਲਬ ਦੱਸ ਸਕਦੇ ਹੈ ਕਿ ਮਤਲਬ ਕਿਹੜੀ ਕਿਹੜੀ ਚੀਜ਼ਾਂ ਜ਼ਿਆਦਾ ਫੇਮਸ ਹੈ ਕਿਹੜੀ ਨਹੀਂ ਮਤਲਬ ਘੁੰਮਾ ਫਿਰਾ ਸਕਦੇ ਤੁਸੀਂ ਮੈਨੂੰ ਹਾਂਜੀ ਹਾਂਜੀ ਤੁਸੀਂ ਕਦ ਤੱਕ ਫਰੀ ਹੈ ਜੀ ਠੀਕ ਹੈ ਭਾਅ ਜੀ ਮੈਂ ਤੁਹਾਨੂੰ ਨਾ ਆਉਣ ਤੋਂ ਇੱਕ ਵਾਰੀ ਪਹਿਲਾਂ ਕਾਲ ਕਰੂੰਗਾ ਤੁਸੀਂ ਮੈਨੂੰ ਮਤਲਬ ਸਾਰਾ ਕੁਛ ਘੁੰਮਾ ਦਿਓ ਮੈਂ ਨਾ ਇੱਕ ਮਤਲਬ ਵੀਡੀਓ ਪਾਉਣੀ ਹੈ ਯੂਟਿਊਬ 'ਤੇ ਅਤੇ ਮੈਂ ਮਤਲਬ ਯੂਟਿਊਬ 'ਤੇ ਪੰਜਾਬ ਮਤਲਬ ਫੂਡ ਬਾਰੇ ਮਤਲਬ ਪਾਉਣੀ ਹੈ ਵੀਡੀਓ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਥੈਂਕ ਯੂ ਮੈਂ ਜਦੋਂ ਵੀ ਆਉਂਗਾ ਨਾ ਤੁਹਾਨੂੰ ਫੋਨ ਕਰੂੰਗਾ ਪਹਿਲਾਂ ਆਉਣ ਤੋਂ ਪਹਿਲਾਂ ਠੀ ਠੀਕ ਹੈ ਭਾਅ ਜੀ ਥੈਂਕ ਯੂ